ਹੈਲੋ ਹਾਂਜੀ ਸਰ ਨਿਊ ਕਲੈਕਸ਼ਨ ਗਾਰਮੈਂਟ ਤੋਂ ਬੋਲਦੇ ਸਰ ਬੂਟ ਕਿਗਾਰਡਿੰਗ ਗੱਲ ਕਰਨੀ ਸੀਗੀ ਸਰ ਆਪਣੇ ਓਲ ਪ੍ਰਕਾਰ ਦੀ ਵੀ ਵਰਾਇਟੀ ਹੁੰਦੀ ਆ ਹਾਂਜੀ ਸਰ ਰੈਡ 'ਚ ਉਹਦੇ ਮਤਲਬ ਫੇਰ ਅਲੱਗ ਤੋਂ ਚਾਰਜਿਸ ਨੇ ਜੀ ਅਤੇ ਸਰ ਮਤਲਬ ਇੱਥੇ ਮਤਲਬ ਓ ਦੂਜ ਉਹ ਵੀ ਮਿਲਦੇ ਇੱਥੇ ਜਿਵੇਂ ਕਹਿੰਦੇ ਡਿਸਕਾਊਂਟ ਵੰਨ ਗੈਟ ਵੰਨ ਫ੍ਰੀ ਇਹ ਜਿਹੀ ਵੀ ਕੋਈ ਔਫਰ ਏ ਸਰ ਠੀਕ ਮਤਲਬ ਸਰ ਸਰ ਏ ਇਹ ਮਤਲਬ ਸਰ ਸਾਰੇ ਆਪਾਂ ਰੈਡ ਟੇਪ ਦੇ ਵਧੀਆ ਮਿਲਦੀਆਂ ਉਰੀਜਨਲ ਨੇ ਅਤੇ ਸਰ ਸਟਾਰਟਿੰਗ ਕੀ ਆ ਰੈਡ ਟੇਪ ਦੀ ਅਤੇ ਮਤਲਬ ਫਾਈਵ ਥਾਊਜੈਂਟ ਤੱਕ ਨੇ ਜਾਂ ਇਹ ਤੋਂ ਵੀ ਅਬੱਵ ਤੱਕ ਨੇ

ਅਤੇ ਫਿਰ ਮਤਲਬ ਜਦੋਂ ਮਤਲਬ ਜਿਵੇਂ ਫੈਸਟੀਵਲਸ ਆਉਂਦੇ ਉਹਨਾਂ 'ਤੇ ਵੀ ਕੋਈ ਡਿਸਕਾਊਂਟ ਹੁੰਦਾ ਜਾਂ ਉਹੀ ਰਹਿੰਦਾ ਸੇਮ ਠੀਕ ਹੈ ਅਤੇ ਸਰ ਆਪਣੀ ਸ਼ੋਪ ਕੋਈ ਹੋਰ ਵੀ ਹੈ ਕਿਤੇ ਕਿ ਇਕੱਲੀ ਬਰਨਾਲੇ 'ਚ ਜੀ ਅੱਛਾ ਬਰਨਾਲੇ 'ਚ ਹੈ ਇੰਸਟਾ ਇੰਸਟਾਗ੍ਰਾਮ 'ਤੇ ਸਰ ਕੀ ਨੇਮ 'ਤੇ ਹੈ ਜੀ

ਬਿੱਕੀ ਸ਼ੂਜ਼ ਠੀਕ ਚਲੋ ਠੀਕ ਹੈ ਸਰ ਓਕੇ ਜੀ